ਪੰਛੀ ਦੇਖਣ ਵਿੱਚ ਬਹੁਤ ਸੋਹਣੇ ਲੱਗਦੇ ਹਨ ਅਤੇ ਇਹਨਾਂ ਨੂੰ ਦੇਖਣਾ ਵੀ ਬਹੁਤ ਚੰਗਾ ਲੱਗਦਾ ਹੈ ਇਹਨਾਂ ਨੂੰ ਦੇਖ ਕੇ ਮਨ ਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਦੇਖਦੇ ਸਾਰ ਮਨ ਖਿੜ ਉੱਠਦਾ ਹੈ ਪੰਛੀ ਦੇਖਣ ਵੀ ਦੇਖ ਬੱਚਿਆਂ ਨੂੰ ਦੇਖਣ ਵਾਸਤੇ ਕਈ ਤਰ੍ਹਾਂ ਦੇ ਉਪਕਰਨਾਂ ਦੀ ਲੋੜ ਹੁੰਦੀ ਹੈ ਕਈ ਵਾਰੀ ਤਾਂ ਪੰਛੀ ਨੰਗੀ ਅੱਖ ਨਾਲ ਵੀ ਦੇਖੇ ਜਾ ਸਕਦੇ ਹਨ ਪਰ ਕਈ ਵਾਰੀ ਪੰਛੀ ਨੇੜੇ ਹੁੰਦੇ ਹਨ ਅਤੇ ਕਈ ਵਾਰੀ ਪੰਛੀ ਦੂਰ ਹੁੰਦੇ ਹਨ ਜਿਹੜੇ ਦੂਰ ਪੰਛੀ ਹੁੰਦੇ ਆ ਉਹਨਾਂ ਨੂੰ ਦੂਰਬੀ ਦੂਰਬੀਨ ਰਾਹੀਂ ਦੇਖਿਆ ਜਾ ਸਕਦਾ ਹੈ ਦੂਰਬੀਨ ਨਾਲ ਦੇਖਣ ਸਾਨੂੰ ਦੂਰ ਦੇ ਪੰਛੀ ਨੇੜੇ ਅਤੇ ਦੇਖੇ ਜਾ ਸਕਦੇ ਹਨ ਅਤੇ ਕਈ ਵਾਰੀ ਪੰਛੀਆਂ ਨੂੰ ਕੈਮਰੇ ਦੀ ਫੋਟੋ ਖਿੱਚ ਕੇ ਵੀ ਦਿੱਤਾ ਜਾ ਦੇਖਿਆ ਜਾ ਸਕਦਾ ਹੈ ਪੰਛੀ ਨੂੰ ਹਰ ਤਰ੍ਹਾਂ ਦੇ ਤਰੀਕੇ ਨਾਲ ਦੇਖਿਆ ਜਾ ਸਕਦਾ ਜੇ ਤੁਸੀਂ ਕੋਲ ਹੋ ਤਾਂ ਪੰਛੀ ਨੂੰ ਨੇੜੇ ਹੋ ਕੇ ਦੇਖ ਸਕਦੇ ਹੋ ਜੇ ਤੁਸੀਂ ਦੂਰ ਹੋ ਤਾਂ ਪੰਛੀ ਨੂੰ ਦੂਰਬੀਨ ਦੇ ਨਾਲ ਦੇਖ ਸਕਦੇ ਹੋ ਕੈਮਰੇ ਨਾਲ ਤੁਸੀਂ ਉਹਨਾਂ ਦੀ ਫੋਟੋ ਖਿੱਚ ਸਕਦੇ ਹੋ ਫੋਟੋ ਖਿੱਚ ਕੇ ਫਿਰ ਤੁਸੀਂ ਉਹਨੂੰ ਮਤਲਬ ਕਿ ਆਪਣੇ ਕੋਲ ਹੁੰਦਾ ਪ੍ਰਤੀਤ ਕਰ ਸਕਦੇ ਹੋ ਪੰਛੀ ਦੇਖਣ ਵਿੱਚ ਬਹੁਤ ਸੋਹਣੇ ਲੱਗਦੇ ਹਨ ਇਹਨਾਂ ਨਾਲ ਇਹਨਾਂ ਨੂੰ ਦੇਖ ਕੇ ਮਨ ਨੂੰ ਖੁਸ਼ੀ ਪ੍ਰਗਟ ਹੁੰਦੀ ਹੈ ਪੰਛੀਆਂ ਨੂੰ ਦੇਖਣਾ ਅੱਖਾਂ ਨੂੰ ਵੀ ਬੜੀ ਰਾਹਤ ਮਹਿਸੂਸ ਕਰਦਾ ਸਵੇਰੇ ਸਵੇਰੇ ਇਹਨਾਂ ਦੇ ਚਿਹਾਹਟ ਵੀ ਚੰਗੀ ਲੱਗਦੀ ਹੈ ਅਸੀਂ ਜੇ ਕੈਮਰੇ ਨਾਲ ਪੰਛੀ ਨੂੰ ਦੇਖਾਂਗੇ ਤਾਂ ਫਿਰ ਅਸੀਂ ਕੈਮਰੇ ਵਿੱਚ ਉਹਨਾਂ ਦੀ ਫੋਟੋ ਵੀ ਖਿੱਚ ਸਕਦੇ ਹਾਂ ਫੋਟੋਆਂ ਨੂੰ ਫਿਰ ਅਸੀਂ ਕਰ ਖਿੱਚ ਕੇ ਆਪਣੇ ਕਮਰੇ ਵਿੱਚ ਵੀ ਲਾ ਸਕਦੇ ਹਾਂ ਅਤੇ ਦੂਰਬੀਨ ਨਾਲ ਜੇ ਦੇਖਣਾ ਤਾਂ ਦੂਰਬੀਨ ਨੂੰ ਤੁਸੀਂ ਦੂਰ ਦੂਰਬੀਨ ਨਾਲ ਅਸੀਂ ਉਹਦਾ ਲੈਂਜ ਅਦਲ ਬਦਲ ਸਕਦੇ ਹਾਂ ਕਦੀ ਲੈਂਜ ਨੇੜੇ ਦਾ ਪਾ ਸਕਦੇ ਹਾਂ ਕਦੀ ਦੂਰ ਦਾ ਪਾ ਸਕਦੇ ਹਾਂ ਇਸ ਕਰਕੇ ਪੰਛੀਆਂ ਨੂੰ ਦੇਖਣਾ ਸਾਡੇ ਵਾਸਤੇ ਸਾਡੇ ਮਨ ਨੂੰ ਬੜਾ ਚੰਗਾ ਲੱਗਦਾ ਹੈ ਪੰਛੀ ਦੇਖਣ ਨਾਲ ਸਰੀਰ ਨੂੰ ਸਰੀਰ ਦੇ ਵਿੱਚ ਐਨਰਜੀ ਆਉਂਦੀ ਹੈਗੀ ਅਸੀਂ ਕਈ ਤਰ੍ਹਾਂ ਦੇ ਪੰਛੀ ਵੇਖੇ ਹਨ ਪੰਛੀਆਂ ਨੂੰ ਵੇਖ ਵੇਖ ਕੇ ਸਾਨੂੰ ਇਹ ਹੁੰਦਾ ਕਿ ਕੁਦਰਤ ਨੇ ਕਿੰਨੀ ਸੋਹਣੀ ਚੀਜ਼ ਬਣਾਈ ਹੈ ਪੰਛੀਆਂ ਨੂੰ ਬਣਾ ਕੇ ਪੰਛੀ ਕਈ ਤਰ੍ਹਾਂ ਦੇ ਪੰਛੀ ਕਬੂਤਰ ਹੁੰਦਾ ਹੈ ਤੋਤਾ ਹੁੰਦਾ ਹੈ ਕਈ ਤਰ੍ਹਾਂ ਦੇ ਉੱਡਣ ਵਾਲੇ ਪੰਛੀ ਚਿੜੀਆਂ ਮੋਰ ਯੇ ਵੋ ਸਾਰਾ ਵੇਖ ਕੇ ਸਾਨੂੰ ਇਹ ਚੰਗਾ ਇਹ ਚੀਜ਼ਾਂ ਦੇਖਣ ਨੂੰ ਚੰਗੀਆਂ ਲੱਗਦੀਆਂ ਕਿ ਕੁਦਰਤ ਨੇ ਇੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹਨ ਜਿਹੜੇ ਕਈ ਤਰ੍ਹਾਂ ਦੇ ਰੰਗ ਬਿਰੰਗੀਆਂ ਚਿੜੀਆਂ ਹੁੰਦੀਆਂ ਹਨ ਪਰ ਅੱਜ ਕੱਲ੍ਹ ਪੰਛੀਆਂ ਨੂੰ ਕੈਦ ਵੀ ਕੀਤਾ ਜਾਂਦਾ ਹੈ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਪੰਛੀ ਸਾਡੀ ਪੰਛੀਆਂ ਦਾ ਜੀਵਨ ਹੀ ਉੱਡਣ ਵਾਸਤੇ ਹੈ ਪੰਛੀ ਉੱਡ ਕੇ ਆਪਣੀਆਂ ਜਗ੍ਹਾ 'ਤੇ ਪਹੁੰਚ ਜਾਣ ਆਪਣਾ ਦਾਣਾ ਪਾਣੀ ਚੁਣਨ ਅਤੇ ਆਪਣੇ ਜੀਵਨ ਜੀ ਆਪਣਾ ਸਾਰਾ ਵੇਖਣ ਚਾਖਣ